ਹਾਂ ਮੈਂ ਸ਼ੋਸ਼ਲ ਮੀਡੀਆ 'ਤੇ ਆਪਣੀ ਪਿਕਸ ਪੋਸਟ ਕਰਦਾ ਹਾਂ ਇੰਸਟਾਗ੍ਰਾਮ 'ਤੇ ਫੇਸਬੁੱਕ 'ਤੇ ਕਿ ਅਸੀਂ ਆਪਣੇ ਫ਼ੋਨ ਵਿੱਚ ਕਾਫੀ ਟਾਈਮ ਤੱਕ ਫੋਟੋਆਂ ਕੈਰੀ ਕਰ ਕਰਕੇ ਨਹੀਂ ਰੱਖ ਸਕਦੇ ਇਸ ਕਰਕੇ ਇੰਸਟਾਗ੍ਰਾਮ 'ਤੇ ਫੇਸਬੁੱਕ 'ਤੇ ਪੋਸਟ ਕਰਦੇ ਹਾਂ ਅਤੇ ਆਪਣੇ ਨਾਲ਼ ਜੁੜੇ ਹੋਏ ਦੋਸਤਾਂ ਨੂੰ ਅਸੀਂ ਆਪਣੀਆਂ ਪਿਕਸ ਦਿਖਾ ਸਕਦੇ ਹਾਂ ਬਈ ਅਸੀਂ ਕਿੱਥੇ ਅਤੇ ਕਿਵੇਂ ਦੀ ਜ਼ਿੰਦਗੀ ਜੀ ਰਹੇ ਹਾਂ